ਵੈਸੇ ਤਾਂ ਡਰਾਇੰਗ ਪੇਂਟਿੰਗ ਕਿਸੇ ਵੀ ਉਮਰ ਵਿੱਚ ਸਿੱਖੀ ਜਾ ਸਕਦੀ ਹੈ ਲੇਕਿਨ ਛੋਟੇ ਬੱਚੇ ਤੋਂ ਤਿੰਨ ਤੋਂ ਬਾਰਾਂ ਸਾਲ ਦੇ ਬੱਚੇ ਨੂੰ ਇਹ ਸਿੱਖਣੀ ਚਾਹੀਦੀ ਹੈ ਅਤੇ ਜੇ ਕੋਈ ਤੀਹ ਜਾਂ ਚਾਲੀ ਸਾਲ ਦੇ ਵਿੱਚ ਸਿੱਖ ਵੀ ਲੈਂਦਾ ਹੈ ਤਾਂ ਉਹ ਆਪਣੇ ਆਪ ਨੂੰ ਬਹੁਤ ਪ੍ਰਸਿੱਧ ਸਮਝਦਾ ਹੈ